ਅਜਵਾਇਣ ਦੀ ਜੜ੍ਹ ਨੂੰ ਕਿਹਾ ਜਾਂਦਾ ਹੈ ਇਹਦੇ ਇ ਵਿਟਾਮਿਨ ਬੀ ਵਿਟਾਮਿਨ ਸੀ ਅਤੇ ਵਿਟਾਮਿਨ ਕੇ ਦਾ ਇੱਕ ਬਹੁਤ ਵਧੀਆ ਸੋਰਸ ਆ ਅਤੇ ਐਂਟੀਓਕਸੀਡੈਂਟ ਬਹੁਤ ਵਧੀਆ ਤੌਰ 'ਤੇ ਐਂਟੀਓਕਸੀਡੈਂਟ 'ਤੇ ਕੰਮ ਕਰਦਾ ਅਤੇ ਬੋਡੀ ਵਿੱਚ ਸੋਜਿਸ਼ ਨੂੰ ਵੀ ਠੀਕ ਕਰ ਦਿੰਦਾ ਹੈ ਉਗਨੀ ਉਗਨੀ ਖਾਣ ਵਾਲਾ ਇੱਕ ਸੀ ਫੂਡ ਲਾਈਕ ਹੈ ਖਾਣ ਵਾਲਾ ਫੂਡ ਹੈ ਬੈਰੀਜ ਲਾਈਕ ਫੂਡ ਹੈ ਅਤੇ ਇਹ ਪੌਦਿਆਂ ਦੀ ਪ੍ਰਜਾਤੀ ਹੈ ਇਹ ਜੈਮ ਵਿੱਚ ਪਾ ਕੇ ਖਾ ਜਾਂਦੇ ਹਾਂ ਜਾਂ ਸਬਜ਼ੀਆਂ ਵਿੱਚ ਪਾ ਕੇ ਖਾ ਜਾਂਦੇ ਆ ਅਤੇ ਇਹਨੂੰ ਸੁਕਾ ਕੇ ਵੀ ਖਾਇਆ ਜਾ ਸਕਦਾ ਹੈ ਫਿੰਗਰ ਸਿਟਰੀਓਨ ਇਸਨੂੰ ਬੁੱਧਾ ਦੀ ਉਂਗਲੀ ਦੇ ਤੌਰ 'ਤੇ ਵੀ ਕਿਹਾ ਜਾਂਦਾ ਅਤੇ ਉਂਗਲੀਆਂ ਦੇ ਇੱਕ ਸਮੂਹ ਜਿਹਾ ਹੀ ਲੱਗਦਾ ਹੈ ਇਸ ਨੂੰ ਸਮੁੰਦਰੀ ਭੋਜਨ ਦੇ ਨਾਲ ਸਲਾਦ ਦੇ ਵਿੱਚ ਅਤੇ ਚੌਲਾਂ ਦੇ ਵਿੱਚ ਪਾ ਕੇ ਖਾਧਾ ਜਾ ਸਕਦਾ ਹੈ